ਭੰਗੜਾ ਪੰਜਾਬ ਦਾ ਬਹੁਤ ਹੀ ਪ੍ਰਸਿੱਧ ਲੋਕ ਨਾਚ ਹੈ ਇਸ ਨੂੰ ਕਈ ਮੌਕਿਆਂ ਉੱਤੇ ਕੀਤਾ ਜਾਂਦਾ ਹੈ ਅੱਜ ਕੱਲ੍ਹ ਭੰਗੜੇ ਨੂੰ ਵਧਾਵਾ ਦੇਣ ਲਈ ਸਕੂਲ ਕਾਲਜ ਵੱਲ ਖ਼ਾਸ ਤੌਰ ਉੱਤੇ ਬੱਚਿਆਂ ਨੂੰ ਸਿਖਾਉਂਦੇ ਹਨ ਅਤੇ ਇਸ ਦੇ ਉੱਤੇ ਕਈ ਪ੍ਰਕਾਰ ਦੀ ਪ੍ਰਤੀਯੋਗਤਾ ਵੀ ਹੁੰਦੀਆਂ ਹਨ ਭੰਗੜਾ ਇੱਕ ਅਜਿਹਾ ਲੋਕ ਨਾਚ ਹੈ ਜਿਸ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ ਖ਼ਾਸ ਤੌਰ ਉੱਤੇ ਪੰਜਾਬੀ ਇਸ ਨੂੰ ਤਾਂ ਹਰ ਮੌਕੇ ਉੱਤੇ ਕਰਦੇ ਹਨ ਬਲਕਿ ਭਾਰਤ ਵਿੱਚ ਹੀ ਹੋਰ ਲੋਕ ਨਾਚ ਵਿੱਚ ਭੰਗੜੇ ਦੀ ਹਰ ਝਲਕ ਦਿੱਖਦੀ ਹੈ ਹੁਣ ਜਦ ਅਸੀਂ ਕਹੀਏ ਇਹਨੂੰ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ ਤਾਂ ਉਹਦਾ ਮਤਲਬ ਇਹ ਹੈ ਕਿ ਭੰਗੜਾ ਜਦ ਉਹਨੂੰ ਬਾਹਰ ਦੇ ਸ਼ੋਜ ਜਿਵੇਂ ਕਿ ਕੋਈ ਬਾਹਰ ਦਾ ਵੀ ਕੋਈ ਮਸ਼ਹੂਰ ਸ਼ੋ ਹੋਵੇ ਉਸ ਵਿੱਚ ਵੀ ਕੀਤਾ ਜਾਂਦਾ ਹੈ ਅਤੇ ਉੱਥੇ ਵੀ ਕਾਫ਼ੀ